ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਹੈਲੋ ਹਾਂਜੀ ਅਸੀਂ ਕਸ਼ਮੀਰ ਤੋਂ ਘੁੰਮਣ ਵਾਸਤੇ ਆ ਰਹੇ ਹਾਂ ਅਤੇ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕੁਛ ਦੇਖਣ ਵਾਸਤੇ ਜਗ੍ਹਾ ਘੁੰਮਾ ਸਕਦੇ ਹੋ ਹਾਂਜੀ ਇੱਥੇ ਦੇਖਣ ਵਾਸਤੇ ਕਿਹੜੀਆਂ ਕਿਹੜੀਆਂ ਜਗ੍ਹਾ ਹੈਗੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਮੈਨੂੰ ਥੋੜ੍ਹਾ ਦੱਸ ਸਕਦੇ ਹੋ ਤੁਸੀਂ

ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਸਰ ਚਲੋ ਸਰ ਠੀਕ ਹੈ ਅਸੀਂ ਆਪਣੀ ਫੈਮਲੀ ਦੇ ਨਾਲ ਥੋੜ੍ਹੇ ਦਿਨਾਂ ਤੱਕ ਘੁੰਮਣ ਵਾਸਤੇ ਆਵਾਂਗੇ ਫਿਰ ਤੁਸੀਂ ਸਾਨੂੰ ਇਹ ਜਗ੍ਹਾ ਘੁੰਮਾ ਦਿਓ ਠੀਕ ਹੈ ਸਰ ਚਲੋ ਠੀਕ ਸਰ ਆਪਾਂ ਥੋੜ੍ਹੇ ਦਿਨਾਂ ਤੱਕ ਆਵਾਂਗੇ ਫਿਰ ਸਾਨੂੰ ਤੁਸੀਂ ਘੁੰਮਾ ਦਿਓ ਕਿ ਧੰਨਵਾਦ ਤੁਹਾਡਾ ਬਹੁਤ ਬਹੁਤ